ਇੰਟਰਨੈਟ ਅਤੇ ਅਖਬਾਰ ਸਾਨੂੰ ਬੈਂਕ ਨੀਤੀਆਂ ਬਾਰੇ ਬਹੁਤ ਜਾਣਕਾਰੀ ਦਿੰਦੇ ਹਨ ਇਹ ਇੱਕ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੇ ਹਨ ਇੰਟਰਨੈਟ 'ਤੇ ਆਪਾਂ ਨੂੰ ਬੈਂਕ ਨੀਤੀਆਂ ਦਾ ਬਹੁਤ ਚੰਗੀ ਤਰ੍ਹਾਂ ਪਤਾ ਚੱਲ ਜਾਂਦਾ ਹੈ ਅੱਜ ਕੱਲ੍ਹ ਬੈਂਕ ਆਪਦੀ ਐਡ ਵੀ ਟ ਇੰਟਰਨੈਟ 'ਤੇ ਕਰਦੇ ਹਨ ਅਤੇ ਆਪਾਂ ਨੂੰ ਉਹਨਾਂ ਦੀ ਵੈਬਸਾਈਟ ਤੋਂ ਹੀ ਹਰ ਚੀਜ਼ ਜਿਵੇਂ ਕਿ ਲੋਨ ਇੰਸ਼ੋਰੈਂਸ ਆਦਿ ਚੀਜ਼ਾਂ ਬਾਰੇ ਪਤਾ ਚੱਲ ਜਾਂਦਾ ਹੈ ਅਖਬਾਰਾਂ ਨਾਲ ਵੀ ਆਪਾਂ ਨੂੰ ਬੈਂਕ ਨੀਤੀਆਂ ਦਾ ਬਹੁਤ ਚੰਗੀ ਤਰ੍ਹਾਂ ਆਪਾਂ ਉਹਨਾਂ ਬਾਰੇ ਪੜ੍ਹ ਸਕਦੇ ਹਾਂ ਨਾਲ ਅਖਬਾਰ ਇੱਕ ਪਰੂਫ ਵੀ ਹੁੰਦਾ ਹੈ ਕੱਲ੍ਹ ਨੂੰ ਆਪਾਂ ਕੋਈ ਬੈਂਕ ਨੀਤੀ ਜੇ ਇੱਧਰ ਉੱਧਰ ਪੜ੍ਹ ਲਈਏ ਅਤੇ ਬੈਂਕ ਵਾਲਾ ਕੁਝ ਹੋਰ ਦੱਸੇ ਆਪਾਂ ਉਹਨਾਂ ਨੂੰ ਦਿਖਾ ਸਕਦੇ ਹਾਂ ਕਿ ਬਈ ਤੁਹਾਡਾ ਅਖਬਾਰ ਇਹ 'ਚ ਆਹ ਸੀ ਅਸਲੀਅਤ ਵਿੱਚ ਉਹਨਾਂ ਦੇ ਕੁਛ ਹੋਰ ਹੋਵੇ